ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਡਮ ਅਸੀਂ ਨਾ ਪਟਿਆਲਾ ਸ਼ਹਿਰ ਦੇ ਵਿੱਚ ਨਵੇਂ ਆਏ ਹੈ ਤੁਹਾਡੇ ਸਿਟੀ 'ਚ ਹੀ ਤੁਹਾਡੇ ਨਜ਼ਦੀਕ ਹੀ ਲੋਕੇਲਟੀ 'ਚ ਮੈਡਮ ਮੈਂ ਇਹ ਪਤਾ ਕਰਨਾ ਸੀਗਾ ਵੀ ਇੱਥੋਂ ਆਪਾਂ ਨੂੰ ਫਰੈਸ਼ ਸਬਜ਼ੀਆਂ ਵਗੈਰਾ ਕਿੱਥੋਂ ਮਿਲ ਸਕਦੀ ਹੈ ਨੇੜਿਓਂ ਅੱਛਾ ਜੀ ਠੀਕ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅਤੇ ਮੈਡਮ ਮੰਡੀ 'ਚ ਸਬਜ਼ੀ ਮਿਲਣੀ ਕਿੰਨੇ ਵਜੇ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਅਤੇ ਮੈਡਮ ਉੱਥੇ ਫਰੂਟ ਵਗੈਰਾ ਵੀ ਉੱਥੇ ਵਧੀਆ ਮਿਲ ਜਾਣਗੇ ਜਿਵੇਂ ਸਾਡੇ ਬੱਚਿਆਂ ਨੂੰ ਕੀ ਹੁੰਦਾ ਕਿ ਇੰਮਪੋਰਟਿਡ ਐਪਲ ਹੋਣ ਇੰਮਪੋਰਟਿਡ ਸੇਬ ਵਗੈਰਾ ਉਹ ਵੀ ਮਿਲ ਜਾਂਦੇ ਆ ਅੱਛਾ ਜੀ ਧਨੀਆ ਮੇਥੀ ਵਗੈਰਾ ਸਭ ਮਿਲ ਜਾਂਦਾ ਠੀਕ ਹੈ ਮੈਡਮ ਚਲੋ ਅੱਜ ਫਿਰ ਕੀ ਦਿਨ ਆ ਬੁੱਧਵਾਰ ਮੰਡੀ ਜਿਵੇਂ ਅੱਜ ਕਿੱਥੇ ਲੱਗੀ ਹੋਊ ਅੱਛਾ ਠੀਕ ਹੈ ਮੈਮ ਠੀਕ ਚਲੋ ਮੈਂ ਅੱਜ ਜਾ ਕੇ ਆਉਂਦੀ ਹਾਂ ਮੰਡੀ ਫਿਰ ਤੁਹਾਡੇ ਨਾਲ ਗੱਲ ਕਰਦੀ ਹਾਂ ਠੀਕ ਹੈ ਥੈਂਕ ਯੂ